ਇੱਥੇ ਸਾਡੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪੇਂਟਿੰਗ ਬਣਾਈਆਂ ਜਾਂਦੀਆਂ ਹਨ ਸਾਡੇ ਇੱਥੇ ਪਾਰਕ ਅਤੇ ਸੜਕਾਂ ਦੀਆਂ ਦੀਵਾਰਾਂ ਉੱਤੇ ਬੜੀਆਂ ਸੋਹਣੀਆਂ ਤਸਵੀਰਾਂ ਵੀ ਬਣਾਈਆਂ ਜਾਂਦੀਆਂ ਹਨ ਸਾਡੇ ਇੱਥੇ ਬੜੀਆਂ ਸੋਹਣੀਆਂ ਪੱਥਰ ਦੀਆਂ ਮੂਰਤੀਆਂ ਵੀ ਬਣਾਈਆਂ ਜਾਂਦੀਆਂ ਹਨ ਬੜੀਆਂ ਸੋਹਣੀਆਂ ਮਿੱਟੀ ਦੇ ਮਿੱਟੀ ਦੇ ਬਰਤਨ ਵੀ ਬਣਦੇ ਹਨ ਮਿੱਟੀ ਦੇ ਬਰਤਨ ਜਿਵੇਂ ਕਿ ਕੱਪ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਕਢਾਈ ਛਿਪਾਈ ਵਾਲੇ ਕੱਪੜੇ ਬਹੁਤ ਤਰ੍ਹਾਂ ਦੇ ਬਣਦੇ ਹਨ ਲੋਕ ਬਹੁਤ ਪਸੰਦ ਕਰਦੇ ਹਨ ਔਰਤਾਂ ਹਰ ਤਿਉਹਾਰ ਉੱਤੇ ਕਢਾਈ ਛਿਪਾਈ ਵਾਲੇ ਕੱਪੜੇ ਬਣਵਾਉਂਦੀਆਂ ਹਨ ਤਰ੍ਹਾਂ ਤਰ੍ਹਾਂ ਦੇ ਕੱਪੜੇ ਬਣਾਏ ਬਣਾਏ ਜਾਂਦੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਇਨ ਵੀ ਪੈਂਦੇ ਹਨ ਲੋਕ ਬਹੁਤ ਪਸੰਦ ਕਰਦੇ ਹਨ ਅਤੇ ਹਰ ਕੋਈ ਤਿਉਹਾਰ ਜਾਂ ਕੋਈ ਵੀ ਮੌਕੇ ਉੱਤੇ ਔਰਤਾਂ ਸੋਹਣੇ ਸੋਹਣੇ ਕੱਪੜੇ ਬਣਵਾਉਂਦੀਆਂ ਹਨ ਅਤੇ ਕੱਪੜੇ ਉੱਪਰ ਪੇਂਟਿੰਗ ਵੀ ਛਪਵਾਉਂਦੀਆਂ ਹਨ